ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਕੁਕਿੰਗ ਕਰਨਾ ਅਤੇ ਮੈਂ ਹੌਲੀ ਹੌਲੀ ਏਜ਼ ਦੇ ਹਿਸਾਬ ਨਾਲ਼ ਕੁਕਿੰਗ ਕਰੀ ਗਿਆ ਹੋਰ ਵਧੀਆ ਕੁਕਿੰਗ ਹੋਈ ਗਈ ਅਤੇ ਮੈਂ ਆਪਣੇ ਘਰ ਪਰਿਵਾਰ ਨੂੰ ਵੀ ਖਾਣਾ ਆਪਣੇ ਹੱਥੀਂ ਬਣਾ ਕੇ ਖਲਾਂਦਾ ਹਾਂ ਉਹ ਵੀ ਬਹੁਤ ਵਧੀਆ ਕਹਿੰਦੇ ਵੀ ਖਾਣਾ ਬਹੁਤ ਵਧੀਆ ਬਣਾਉਂਦਾ ਮੁੰਡਾ ਅਤੇ ਮੈਂ ਸੋਚਿਆ ਇਸ ਕੰਮ ਨੂੰ ਮੈਂ ਇਹੀ ਕੰਮ ਮੇਰੇ ਲਈ ਬਣਿਆ ਮੈਂ ਇਸ ਕੰਮ ਨੂੰ ਪੇਸ਼ਾ ਦਿੱਤਾ ਮਤਲਬ ਕਿ ਮੈਂ ਇਹੀ ਕੰਮ ਕਰਨਾ ਫਿਰ ਮੈਂ ਢਾਬੇ ਜਾਂ ਰੈਸਟੋਰੈਂਟ 'ਚ ਅਪਲਾਈ ਕੀਤਾ ਅਤੇ ਮੈਂ ਉੱਥੇ ਕੁਕਿੰਗ ਕਰੀ ਗਿਆ ਉੱਥੇ ਮੈਂ ਬਣਾਉਂਦਾ ਰਿਹਾ ਮੈਂ ਬਹੁਤ ਉੱਥੇ ਕੁਕਿੰਗ ਜ਼ਿਆਦਾ ਕਰੀ ਕਿਉਂਕਿ ਮੈਨੂੰ ਖਾਣੇ ਦਾ ਬਹੁਤ ਜ਼ਿਆਦਾ ਹੀ ਸ਼ੌਂਕ ਸੀ ਮੈਂ ਉੱਥੇ ਬਹੁਤ ਸਾਰੀਆਂ ਆਈਟਮਾਂ ਬਣਾਈਆਂ ਦਾਲ ਫ ਦਾਲ ਮੱਖਣੀ ਮਿਕਸ ਵੈੱਜ ਆਲੂ ਮਟਰ ਮਟਰ ਪਨੀਰ ਸ਼ਾਹੀ ਪਨੀਰ ਕੜਾਹੀ ਪਨੀਰ ਪਨੀਰ ਭੁਰਜੀ ਚਿਕਨ ਮਸਾਲਾ ਮਟਰ ਮਸ਼ਰੂਮ ਸੇਬ ਭਾਜੀ ਅਤੇ ਮੈਂ ਚਿਕਨ ਬਹੁਤ ਵਧੀਆ ਬਣਾਉਂਦਾ ਹਾਂ ਸਾਰੀਆਂ ਆਈਟਮਾਂ ਹੀ ਮੈਂ ਬਹੁਤ ਵਧੀਆ ਬਣਾਉਂਦਾ ਹੈ ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਹੀ ਸ਼ੌਂਕ ਸੀ ਅਤੇ ਕਿਆ ਉਹਨੂੰ ਕਹਿੰਦੇ ਮੈਂ ਸ਼ਾਹੀ ਪਨੀਰ ਬਹੁਤ ਵਧੀਆ ਬਣਾਉਂਦਾ ਹਾਂ ਉਸਦੀ ਗਰੇਵੀ ਬਹੁਤ ਵਧੀਆ ਐਡ ਕਰਦਾ ਹਾਂ ਮਟਰ ਮਸ਼ਰੂਮ ਜਿੱਦਾਂ ਪਹਿਲਾਂ ਅਸੀਂ ਤੜਕਾ ਭੁੰਨ ਲਿਆ ਪਿਆਜ਼ ਪਾ ਲਿਆ ਟਮਾਟਰ ਪਾ ਲਏ ਹਰੀ ਮਿਰਚ ਪਾ ਲਿਆ ਉਹਨੂੰ ਭੁੰਨ ਕੇ ਬਾਅਦ 'ਚ ਉਹਨੂੰ ਗਰੈਂਡ ਕਰ ਲਿਆ ਉਹਦੀ ਗਰੇਵੀ ਬਣਾ ਲਈ ਗਰੇਵੀ ਬਣਾਉਣ ਤੋਂ ਬਾਅਦ ਇੱਕ ਸਿੰਪਲ ਤੜਕਾ ਲਾਇਆ ਤੜਕੇ ਦੇ ਵਿੱਚ ਗਰੇਵੀ ਐਡ ਕਰੀ ਗਰੇਵੀ ਐਡ ਕਰਨ ਤੋਂ ਬਾਅਦ ਮ ਮਟਰ ਐਡ ਕਰੇ ਮਟਰ ਐਡ ਕਰਨ ਤੋਂ ਬਾਅਦ ਮਸ਼ਰੂਮ ਐਡ ਕਰੇ ਥੋੜ੍ਹਾ ਜਾ ਇੱਕ ਹਾਫ਼ ਲੀਟਰ ਪਾਣੀ ਪਾ ਦੇਣਾ ਉਹ 'ਚ ਪਾਣੀ ਪਾਉਣ ਤੋਂ ਬਾਅਦ ਬਹੁਤ ਵਧੀਆ ਉਹਦਾ ਟੇਸਟ ਆਉਂਦਾ ਬਹੁਤ ਵਧੀਆ ਫਲੇਵਰ ਆਉਂਦਾ ਉਹਦਾ ਇੱਦਾਂ ਮੈਂ ਸ਼ਾਹੀ ਪਨੀਰ ਬਣਾਉਂਦਾ ਸੇਮ ਟੂ ਸੇਮ ਗਰੇਵੀ ਇੱਦਾਂ ਐਡ ਕਰਦਾ ਬਟ ਉਹਦੇ ਵਿੱਚ ਕਰੀਮ ਐਡ ਕਰੀ ਜਾਂਦੀ ਆ ਅਤੇ ਬਹੁਤ ਵਧੀਆ ਹੀ ਸਵਾਦ ਬਹੁਤ ਵਧੀਆ ਹੀ ਟੇਸਟ ਆਉਂਦਾ ਆ ਕਿਉਂਕਿ ਕੁਕਿੰਗ ਕਰਨਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਵਧੀਆ ਸੀ ਕਰ ਕਰਦਾ ਹਾਂ ਅਤੇ ਮੇਰੇ ਮੇਰੇ ਘਰਦਿਆਂ ਨੇ ਵੀ ਮੈਨੂੰ ਕਦੇ ਰੋਕਿਆ ਨਹੀਂ ਟੋਕਿਆ ਨਹੀਂ ਉਹ ਕਹਿੰਦੇ ਕਰ ਜਿੱਦਾਂ ਜ ਜੋ ਤੇਰੇ ਦਿਲ 'ਚ ਸੋ ਕਰ ਅਤੇ ਔਲ ਦਾ ਵੈਸਟ